ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਸਾਡੇ ਪੰਜਾਬ 'ਚ ਦੇਖੋ ਜਿੱਥੇ ਤੁਸੀਂ ਰਹਿ ਰਹੇ ਹੋ ਇੱਕ ਅੰਮ੍ਰਿਤਸਰ ਲੁਧਿਆਣਾ ਜਲੰਧਰ ਬਾਕੀ ਭੈਣ ਜੀ ਤੁਸੀਂ ਦੂਰ ਕਿੱਥੇ ਜਾਣਾ ਅੰਮ੍ਰਿਤਸਰ 'ਚ ਹੀ ਬੜਾ ਕੁਛ ਘੁੰਮਣ ਨੂੰ ਹੈਗਾ ਤੁਸੀਂ ਇੱਥੇ ਦਰਬਾਰ ਸਾਹਿਬ ਜਾਓ ਜਲ੍ਹਿਆਂਵਾਲਾ ਬਾਗ ਹੈਗਾ ਵਾ ਇੱਧਰ ਦੁਰਗਿਆਣਾ ਮੰਦਰ ਹੋ ਗਿਆ ਇੱਥੇ ਰਾਮ ਤੀਰਥ ਅਤੇ ਬਾਕੀ ਕੋਈ ਗੱਲ ਨਹੀਂ ਫਿਰ ਕੀ ਹੋਇਆ ਜੇ ਤੁਸੀਂ ਨਵੇਂ ਆਪਣੇ ਭੈਣ ਭਰਾ ਹੋ ਅਤੇ ਦੇਖੋ ਰਿਸ਼ਤੇਦਾਰ ਬਾਅਦ 'ਚ ਅਤੇ ਗਲੀ ਗਵਾਂਢ ਪਹਿਲਾਂ ਅਤੇ ਕੋਈ ਨਹੀਂ ਮੈਂ ਤੁਹਾਡੇ ਨਾਲ ਚੱਲ ਪੈਂਦੀ ਹਾਂ ਕਿੰਨੇ ਕੁ ਵਜੇ ਕੋਈ ਗੱਲ ਨਹੀਂ ਮੈਂ ਨਾ ਦੋ ਵਜੇ ਤੁਹਾਡਾ ਗੇਟ ਖੜਕਾ ਦਿੰਦੀ ਹਾਂ ਤੇ ਮੈਂ ਤੁਹਾਡੇ ਨਾਲ ਹੀ ਚੱਲਦੀ ਹਾਂ ਠੀਕ ਐ ਹਾਂਜੀ ਓਕੇ ਜੀ ਮਿਹਰਬਾਨੀ ਜੀ ਓਕੇ ਜੀ